ਹਾਂਜੀ ਬਿਲਕੁਲ ਸਿੱਖਿਆ ਦੀ ਘਾਟ ਕਾਰਨ ਸ਼ਹਿਰੀ ਦੇ ਮੁਕਾਬਲੇ ਪੇਂਡੂ ਖੇਤਰਾਂ ਦੇ ਲੋਕਾਂ ਦੀ ਆਵਾਜ਼ ਨੂੰ ਪਛਾਣਿਆ ਨਹੀਂ ਗਿਆ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਪੇਂਡੂ ਇਲਾਕੇ ਦੇ ਜਿਹੜੇ ਲੋਕ ਹੈ ਉਹਨਾਂ ਦੀ ਸੋਚ ਦਾ ਇਹੀ ਸਮਝਿਆ ਜਾਂਦਾ ਹੈ ਕਿ ਹਾਂਜੀ ਇਹ ਖੇਤੀਬਾੜੀ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ ਤਾਂ ਇਹਨਾਂ ਦੀ ਸੋਚ ਦਾ ਦਾਇਰਾ ਜਿਹੜਾ ਹੈ ਉਹ ਵੀ ਓਨਾ ਕੁ ਹੀ ਹੋਵੇਗਾ ਮਤਲਬ ਇਹਨਾਂ ਦੇ ਜਿਹੜੀਆਂ ਗੱਲਾਂ ਨੇ ਜਾਂ ਇਹਨਾਂ ਦਾ ਜੋ ਕੁਛ ਵੀ ਹੈਗਾ ਸਿਰਫ਼ ਸਾਰਾ ਦਾ ਸਾਰਾ ਜਿਹੜਾ ਹੈ ਉਹ ਖੇਤੀਬਾੜੀ ਦੇ ਨਾਲ ਹੀ ਸੰਪਰਕ ਰੱਖਦਾ ਹੋਵੇਗਾ ਸ਼ਹਿਰੀ ਅਤੇ ਪੇਂਡੂ ਲੋਕਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਵਖਰੇਵਾਂ ਵੇਖਿਆ ਜਾਂਦਾ ਹੈ ਉਹ ਇਸ ਕਰਕੇ ਹੈਗਾ ਹੈ ਕਿ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਤਕਨੋਲੋਜੀਆਂ ਦਾ ਇਸਤੇਮਾਲ ਲੋਕ ਜਿਹੜੇ ਨੇ ਆਪਣੇ ਜੀਵਨ ਦੇ ਵਿੱਚ ਕਰਦੇ ਨੇ ਅਤੇ ਜਿਹੜਾ ਸਾਡਾ ਪੇਂਡੂ ਖੇਤਰ ਹੈਗਾ ਹੈ ਉਹ ਇਹਨਾਂ ਸਾਰੀਆਂ ਤਕਨੋਲੋਜੀਆਂ ਤੋਂ ਕਾਫੀ ਹੱਦ ਤੱਕ ਵਾਂਝਾ ਰਹਿ ਜਾਂਦਾ ਹੈ ਅਤੇ ਜੇ ਉਹਨਾਂ ਤਕਨੋਲੋਜੀਆਂ ਬਾਰੇ ਕਈਆਂ ਨੂੰ ਪਤਾ ਵੀ ਹੈ ਤਾਂ ਮਤਲਬ ਉਹਨਾਂ ਦੀ ਗਿਣਤੀ ਪੇਂਡੂ ਇਲਾਕੇ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਜੇ ਆਪਾਂ ਸਿੱਖਿਆ ਦੀ ਗੱਲ ਕਰੀਏ ਤਾਂ ਪੇਂਡੂ ਇਲਾਕੇ ਦੇ ਵਿੱਚ ਜਿਹੜੇ ਸਕੂਲ ਹੁੰਦੇ ਨੇ ਉਹਨਾਂ ਦਾ ਪੜ੍ਹਾਈ ਦਾ ਤਰੀਕਾ ਅਤੇ ਜਿਹੜੇ ਸ਼ਹਿਰਾਂ ਦੇ ਵਿੱਚ ਸਕੂਲ ਹੁੰਦੇ ਨੇ ਉਹਨਾਂ ਦਾ ਦੋਨਾਂ ਸਕੂਲਾਂ ਦਾ ਪੜ੍ਹਾਉਣ ਦਾ ਜਾਂ ਪੜ੍ਹਾਈ ਦਾ ਜਿਹੜਾ ਹੈਗਾ ਹੈ ਉਹ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ ਕਹਿ ਲਓ ਕਿ ਸ਼ਹਿਰੀ ਸਕੂਲਾਂ ਦੇ ਵਿੱਚ ਜਿਹੜੇ ਮਤਲਬ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਇੱਕ ਜੇਈਆਂ ਇਹੋ ਜਿਹੀਆਂ ਗਤੀਵਿਧੀਆਂ ਜਿਹੜੀਆਂ ਹੈ ਉਹ ਕਰਾਈਆਂ ਜਾਂਦੀਆਂ ਹੈ ਜਿਹਦੇ ਨਾਲ ਕੀ ਹੁੰਦਾ ਹੈ ਉਹਨਾਂ ਦਾ ਮਤਲਬ ਸਰਵ ਪੱਖੀ ਵਿ ਜਿਹੜਾ ਵਿਕਾਸ ਹੈ ਉਹ ਹੁੰਦਾ ਹੈ ਜਦੋਂ ਕਿ ਜਿਹੜੇ ਪੇਂਡੂ ਸਕੂਲ ਹੈਗੇ ਨੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਸਿਰਫ਼ ਉਹਨਾਂ ਦੇ ਜਿਹੜੇ ਕਲਾਸ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਪਾਠ ਪੁਸਤਕਾਂ ਲੱਗੀਆਂ ਹੁੰਦੀਆਂ ਹੈ ਸਿਰਫ਼ ਉਸੇ ਦੇ ਨਾਲ ਸੰਬੰਧਿਤ ਗਿਆਨ ਜਿਹੜਾ ਹੈ ਉਹੀ ਦਿੱਤਾ ਜਾਂਦਾ ਹੈ ਮੇਨ ਮੁਸ਼ਕਲਾਂ ਜਿਹੜੀਆਂ ਹੈਗੀਆਂ ਹੈ ਜਿਹੜੀਆਂ ਕਿ ਪੇਂਡੂ ਇਲਾਕੇ ਦੇ ਵਿੱਚ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਉਹ ਇਹੀ ਹੈਗਾ ਹੈ ਕਿ ਇੱਕ ਤੇ ਬੱਚਿਆਂ ਦੀ ਜਿਹੜੀ ਸਿੱਖਿਆ ਹੈ ਪ੍ਰਣਾਲੀ ਜਿਹੜੀ ਸਿੱਖਿਆ ਪ੍ਰਣਾਲੀ ਹੈਗੀ ਹੈ ਉਹਦੇ ਵਿੱਚ ਕੁਛ ਖ਼ਾਸਾ ਵਿਕਾਸ ਨਹੀਂ ਹੈਗਾ ਜਿਹੜਾ ਅੱਜ ਤੋਂ ਕਹਿ ਲਓ ਕਿ ਤਿੰਨ ਚਾਰ ਸਾਲ ਪਹਿਲਾਂ ਸੀ ਉਹੀ ਤਰੀਕਾ ਜਿਹੜਾ ਬੱਚਿਆਂ ਨੂੰ ਅੱਜ ਵੀ ਪੜ੍ਹਾਇਆ ਜਾ ਰਿਹਾ ਉਸੇ ਤਰੀਕੇ ਦੇ ਨਾਲ ਪੜ੍ਹਾਇਆ ਜਾ ਰਿਹਾ ਦੂਜਾ ਇਹ ਕਿ ਉਚੇਰੀ ਵਿੱਦਿਆ ਦੇ ਲਈ ਜਿੰਨੀ ਹੈ ਵੀ ਕੋਲਜ ਜਿਹੜੇ ਹੈਗੇ ਆ ਜਿੰਨੀਆਂ ਵੀ ਯੂਨੀਵਰਸਿਟੀਆਂ ਹੈਗੀਆਂ ਹੈ ਇਹ ਸਾਰੀਆਂ ਕੀ ਆ ਸ਼ਹਿਰੀ ਇਲਾਕਿਆਂ ਦੇ ਵਿੱਚ ਹੁੰਦੀਆਂ ਹੈ ਜਿਨ੍ਹਾਂ ਦੇ ਨਾਲ ਕੀ ਆ ਆਵਾਜਾਈ ਦੀ ਕੁਛ ਜ਼ਿਆਦਾ ਸਾਧਨ ਨਾ ਹੋਣ ਕਰਕੇ ਜਾਂ ਕਹਿ ਲਓ ਘਰ ਤੋਂ ਜ਼ਿਆਦਾ ਦੂਰੀ 'ਤੇ ਹੋਣ ਕਰਕੇ ਜਿਹੜੇ ਬੱਚੇ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਪਾਸ ਵੀ ਹੋ ਜਾਂਦੇ ਨੇ ਉਹ ਆਪਣੀ ਉਚੇਰੀ ਵਿੱਦਿਆ ਵਾਸਤੇ ਕੀ ਹੈ ਯੂਨੀਵਰਸਿਟੀਆਂ ਜਾਂ ਕਾਲਜਾਂ ਦੇ ਵਿੱਚ ਨਹੀਂ ਜਾ ਪਾਉਂਦੇ ਜਿਹਦੇ ਨਾਲ ਉਹ ਆਪਣੇ ਉਚੇਰੀ ਜਿਹੜੀ ਵਿੱਦਿਆ ਤੋਂ ਵਾਂਝੇ ਰਹਿ ਜਾਂਦੇ ਨੇ ਅਤੇ ਫਿਰ ਤੋਂ ਖੇਤੀਬਾੜੀ ਨੂੰ ਹੀ ਆਪਣੇ ਮੁੱਖ ਕਿੱਤੇ ਵਜੋਂ ਜਾਣ ਲੈਂਦੇ ਨੇ ਜਾਂ ਅਪਣਾ ਲੈਂਦੇ ਨੇ ਫਿਰ ਸ਼ਹਿਰਾਂ ਦੇ ਵਿੱਚ ਕਮਾਈ ਦੇ ਰੁਜ਼ਗਾਰ ਦੇ ਵੀ ਕਈ ਸਾਧਨ ਹੁੰਦੇ ਨੇ ਅਤੇ ਪੇਂਡੂ ਇਲਾਕੇ ਦੇ ਵਿੱਚ ਇੱਕੋ ਇੱਕ ਜਿਹੜਾ ਮੁੱਖ ਤੌਰ 'ਤੇ ਰੁਜ਼ਗਾਰ ਦਾ ਸਾਧਨ ਹੁੰਦਾ ਹੈ ਉਹ ਹੈਗਾ ਖੇਤੀਬਾੜੀ ਇਹਨਾਂ ਸਭ ਚੀਜ਼ਾਂ ਦੇ ਕਰਕੇ ਕੀ ਹੈਗਾ ਹੈ ਪੇਂਡੂ ਲੋਕਾਂ ਦੀ ਮਾਨਸਿਕਤਾ ਦਾ ਵਿਕਾਸ ਵੀ ਕੁਛ ਬਹੁਤਾ ਜ਼ਿਆਦਾ ਨਹੀਂ ਹੋ ਰਿਹਾ ਇੰਨਾ ਸਮਝੇ ਹਾਂ ਕਿ ਆਪਾਂ ਜੇ ਆਪਣੀ ਸਿੱਖਿਆ ਪ੍ਰਣਾਲੀ ਨੂੰ ਥੋੜ੍ਹਾ ਸੁਧਾਰਾਂਗੇ ਜਾਂ ਕਹਿ ਲਓ ਕਿ ਸ਼ਹਿਰੀ ਲੋਕ ਜਿਹੜੇ ਹੈਗੇ ਨੇ ਉਹ ਪੇਂਡੂ ਲੋਕਾਂ ਨੂੰ ਥੋੜ੍ਹਾ ਹੀਣ ਭਾਵਨਾ ਨਾਲ ਦੇਖਦੇ ਨੇ ਕਿਉਂਕਿ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਰਹਿੰਦੇ ਵੀ ਖੁੱਲ੍ਹੇ ਰੇ ਖੁੱਲ੍ਹ ਦਿਲੀ ਦੇ ਨਾਲ ਖਾਣਾ ਵੀ ਖੁੱਲ੍ਹਾ ਖਾਂਦੇ ਨੇ ਪਹਿਨਦੇ ਵੀ ਖੁੱਲ੍ਹਾ ਨੇ ਅਤੇ ਉਹਨਾਂ ਦੇ ਜਿਹੜਾ ਬੋਲਣ ਦਾ ਢੰਗ ਹੈ ਉਹ ਵੀ ਖੁਲਾਸਾ ਹੀ ਹੁੰਦਾ ਹੈ ਕਿ ਉਹ ਕਿਸੇ ਤਰੀਕੇ ਦਾ ਵੀ ਭੇਦਭਾਵ ਨਹੀਂ ਕਰਦੇ ਬੋਲਣ ਲੱਗਿਆਂ ਸੋ ਸ਼ਹਿਰੀ ਲੋਕਾਂ ਦੇ ਵਿੱਚ ਥੋੜ੍ਹੀ ਇਹ ਮਾਨਸਿਕਤਾ ਹੁੰਦੀ ਹੈ ਕਿ ਹਾਂਜੀ ਇਹਨਾਂ ਨੂੰ ਥੋੜ੍ਹਾ ਬੋਲਣ ਦਾ ਢੰਗ ਨਹੀਂ ਹੈਗਾ ਜਾਂ ਕਿਸੇ ਨਾਲ ਉੱਠਣ ਬੈਠਣ ਦਾ ਸਲੀਕਾ ਨਹੀਂ ਹੈਗਾ ਸੋ ਇਸ ਚੀਜ਼ਾਂ ਸਭ ਦੇ ਨਾਲ ਕੀ ਹੁੰਦਾ ਹੈ ਕਿ ਪੇਂਡੂ ਅਤੇ ਸ਼ਹਿਰੀ ਜਿਹੜਾ ਹੁੰਦਾ ਹੈ ਇਹਨਾਂ ਦਾ ਆਪਸੀ ਵਿਤਕਰਾ ਜਿਹੜਾ ਹੈ ਉਹ ਖ਼ਤਮ ਨਹੀਂ ਹੋ ਰਿਹਾ ਜਦੋਂ ਕਿ ਇਹ ਸਭ ਚੀਜ਼ਾਂ ਨੂੰ ਖ਼ਤਮ ਕਰਕੇ ਸਾਨੂੰ ਇਕੱਠੇ ਹੀ ਇਸ ਸਮਾਜ ਦੇ ਵਿੱਚ ਰਹਿਣਾ ਚਾਹੀਦਾ